ਹਰੇਕ ਖੇਤਰ ਦੀ ਆਪਣੀ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ ਅਤੇ ਸਾਡੇ ਪੰਜਾਬ ਦੀ ਖਾਸੀਅਤ ਹੈ ਉਸਦਾ ਖਾਣਾ ਅਸੀਂ ਪੰਜਾਬੀ ਹਾਂ ਮਿਰਚ ਮਸਾਲਾ ਤਲਿਆ ਹੋਇਆ ਖਾਣਾ ਬਹੁਤ ਪਸੰਦ ਕਰਦੇ ਹਾਂ ਲੋਕੀ ਦੂਰ ਦੂਰ ਤੋਂ ਦੂਜੇ ਦੂਜੇ ਸਟੇਟਾਂ ਤੋਂ ਸਾਡੇ ਪੰਜਾਬ ਵੱਲ ਆਉਂਦੇ ਨੇ ਇਸ ਦਾ ਖਾਣਾ ਅਤੇ ਇਸ ਦਾ ਸਵਾਦ ਚੱਖਣ ਲਈ ਬਟਰ ਚਿਕਨ ਮਲਾਈ ਲੱਸੀ ਅੰਮ੍ਰਿਤਸਰ ਦੇ ਕੁਲਚੇ ਛੋਲੇ ਦਾਲ ਮੱਖਣੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਸ਼ਾਹੀ ਪਨੀਰ ਅਤੇ ਇਹੋ ਜਿਹੇ ਬਹੁਤ ਸਾਰੇ ਡਿਸ਼ਿਜ਼ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ ਲੋਕ ਇਹਨਾਂ ਦਾ ਬਹੁਤ ਮਾਣ ਮਾਣਦੇ ਨੇ ਕਹਿੰਦੇ ਨੇ ਜੇ ਕਿਸੇ ਮਨੁੱਖ ਦੇ ਦਿਲ ਦਾ ਰਸਤਾ ਉਸ ਦੇ ਢਿੱਡ ਤੋਂ ਹੋ ਕੇ ਗੁਜਰਦਾ ਹੈ ਅਤੇ ਇਹ ਕਹਾਵਤ ਸਾਡੇ ਪੰਜਾਬੀਆਂ ਨੂੰ ਬਹੁਤ ਸੂਟ ਕਰਦੀ ਆ ਕਿਉਂਕਿ ਅਸੀਂ ਪੰਜਾਬ ਦੇ ਖਾਣ ਪੀਣ ਦੇ ਇੰਨੇ ਸ਼ੌਕੀਨ ਹੁੰਦੇ ਨੇ ਕਿ ਜੇ ਸਾਡਾ ਦਿਲ ਜਿੱਤਣਾ ਹੋਵੇ ਜਾਂ ਸਾਨੂੰ ਮਨਾਉਣਾ ਹੋਵੇ ਤਾਂ ਸਾਨੂੰ ਖੁਆ ਪਿਲਾ ਦਿਓ ਖਾਣ ਪੀਣ ਤੋਂ ਬਾਅਦ ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ ਅਤੇ ਨਾ ਕੇਵਲ ਪੰਜਾਬ ਦੇ ਵਿੱਚ ਪਰ ਅਜਿਹੇ ਹੋਰ ਵੀ ਬਹੁਤ ਖੇਤਰ ਨੇ ਜਿੱਥੇ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਪ੍ਰਸਿੱਧ ਨੇ ਪਰ ਸਾਡੇ ਪੰਜਾਬ ਦੀ ਗੱਲ ਹੀ ਵੱਖਰੀ ਆ ਅਸੀਂ ਪੰਜਾਬੀ ਖਾਣ ਪੀਣ ਦੇ ਇੰਨੇ ਜ਼ਿਆਦਾ ਸ਼ੌਕੀਨ ਹੁੰਦੇ ਨੇ ਅਤੇ ਅਸੀਂ ਨਾ ਅਸੀਂ ਕੇਵਲ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ ਪਰ ਅਸੀਂ ਦੂਜਿਆਂ ਨੂੰ ਖੁਆਣ ਪਿਲਾਣ ਦੇ ਵਿੱਚ ਵੀ ਬਹੁਤ ਵਿਸ਼ਵਾਸ ਰੱਖਦੇ ਨੇ ਅਤੇ ਇਸੇ ਕਰਕੇ ਅਸੀਂ ਆਓ ਭਗਤ ਦੇ ਵਿੱਚ ਇੰਨੇ ਜ਼ਿਆਦਾ ਮਸ਼ਰੂਫ ਨੇ ਕਿ ਸਾਡੇ ਪੰਜਾਬੀਆਂ ਦੀ ਗੱਲ ਹੀ ਵੱਖਰੀ ਆ